ਪੰਜਾਬ ਵਿੱਚ ਕਾਰੋਬਾਰ ਵਿਕਾਸ ਅਤੇ ਵਿਸਥਾਰ ਦੀ ਯੋਜਨਾ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਯੋਜਨਾ ਹੈ ਜੋ ਕਿ ਹਰੇਕ ਕਾਰੋਬਾਰੀ ਦੇ ਬਹੁਤ ਹੀ ਜ਼ਿਆਦਾ ਕੰਮ ਆਉਂਦੀ ਹੈ ਜਿਵੇਂ ਕਿ ਪੰਜਾਬ ਵਿੱਚ ਕੋਈ ਨਵਾਂ ਕਾਰੋਬਾਰੀ ਆਪਣਾ ਕੋਈ ਵੀ ਕਾਰੋਬਾਰ ਕਰਨਾ ਚਾਹੁੰਦਾ ਹੈ ਤਾਂ ਸਰਕਾਰ ਉਸ ਨੂੰ ਇਸ ਯੋਜਨਾ ਦੇ ਤਹਿਤ ਵੱਖ ਵੱਖ ਤਰ੍ਹਾਂ ਦੇ ਸਬਸੀਡੀਸ ਵਗੈਰਾ ਪ੍ਰਦਾਨ ਕਰਦੀ ਹੈ ਜਿਸ ਵਿੱਚ ਬਹੁਤ ਹੀ ਵਧੀਆ ਫਾਇਦਾ ਹੁੰਦਾ ਹੈ ਅਤੇ ਉਹ ਆਪਣੇ ਉਦਯੋਗ ਨੂੰ ਵੱਧ ਤੋਂ ਵੱਧ ਵੱਡਾ ਕਰ ਸਕਦਾ ਹੈ ਜੋ ਕਿ ਬਹੁਤ ਸਾਰੇ ਵਿਅਕਤੀਆਂ ਨੂੰ ਰੁਜ਼ਗਾਰ ਦਿੰਦਾ ਹੈ ਮੈਂ ਸੋਚਦਾ ਹਾਂ ਕਿ ਸਭ ਤੋਂ ਬਹੁਤ ਵਧੀਆ ਯੋਜਨਾ ਹੈ ਕਿਉਂਕੀ ਮੈਂ ਵੀ ਇੱਕ ਬਿਜਨਸਮੈਨ ਬਣਨਾ ਚਾਹੁੰਦਾ ਹਾਂ ਤਾਂ ਕਿ ਮੇਰੀ ਸਰਕਾਰ ਮੇਰੀ ਮੇਰੇ ਬਿਜਨਸ ਨੂੰ ਖੜ੍ਹਾ ਕਰਨ ਅਤੇ ਚਲਾਉਣ ਵਿੱਚ ਹੈਲਪ ਕਰ ਸਕੇ ਤਾਂ ਜੋ ਮੈਂ ਆਪਣੀ ਕੰਟਰੀ ਨੂੰ ਕੰਟ੍ਰੀਬਿਊਟ ਕਰ ਸਕਾਂ ਅਤੇ ਬਹੁਤ ਸਾਰੇ ਲੋਕਾਂ ਨੂੰ ਵੱਖ ਵੱਖ ਉਪਲੱਬਧੀਆਂ ਪ੍ਰਾਪਤ ਕਰਨ ਵਿੱਚ ਮਦਦ ਕਰ ਸਕਾਂ ਤਾਂ ਕਿ ਮੈਂ ਹਰ ਕਿਸੇ ਬੰਦੇ ਨੂੰ ਜੋਬ ਪ੍ਰੋਵਾਈਡ ਕਰ ਸਕਾਂ ਇਹ ਮੇਰਾ ਸੁਪਨਾ ਹੈ ਤਾਂ ਕਿ ਮੈਂ ਆਪਣਾ ਮਨਪਸੰਦ ਦਾ ਕਾਰੋਬਾਰ ਸ਼ੁਰੂ ਕਰ ਸਕਾਂ ਅਤੇ ਇੱਕ ਬਹੁਤ ਹੀ ਵਧੀਆ ਸਫਲਤਾਪੂਰਵਕ ਕਾਰੋਬਾਰੀ ਬਣ ਸਕਾਂ